ਕਲਾ ਦੇ ਨਾਲ ਅਸੀਂ ਬਹੁਤ ਕੁਝ ਸਿੱਖ ਸਕਦੇ ਹਾਂ ਇਹਨਾਂ ਨਾਲ ਸਾਡਾ ਬਹੁਤ ਵਿਕਾਸ ਹੁੰਦਾ ਹੈ ਇਹਨਾਂ ਨਾਲ ਸਾਡਾ ਬੌਧਿਕ ਵਿਕਾਸ ਹੁੰਦਾ ਹੈ ਇਸ ਦੇ ਦੁਆਰਾ ਅਸੀਂ ਕਿਸੇ ਵੀ ਤਰ੍ਹਾਂ ਦਾ ਲੋਗੋ ਆਦਿ ਵੀ ਬਣਾਉਣਾ ਸਿੱਖ ਸਕਦੇ ਹਾਂ ਅੱਜ ਕੱਲ੍ਹ ਹਰ ਤਰ੍ਹਾਂ ਦੇ ਟਰੈਡ ਮਾਰਕ ਵੀ ਕਲਾ ਅਤੇ ਸ਼ਿਲਪਕਾਰੀ ਖੇਤਰ ਦੇ ਅਧੀਨ ਹੀ ਆਉਂਦੇ ਹਨ ਕਲਾ ਦੇ ਨਾਲ ਹੀ ਅਸੀਂ ਕਿਸੇ ਨਾਲ ਵੀ ਸਮਝੌਤਾ ਕਰ ਸਕਦੇ ਹਾਂ